ਅਸੀਂ ਪੰਜਾਬ ਦੇ ਰਹਿਣ ਵਾਲੇ ਵਾਸੀ ਹਾਂ ਅਤੇ ਸਾਡੀ ਮਾਂ ਬੋਲੀ ਪੰਜਾਬੀ ਹੈ ਸ਼ੁਰੂ ਤੋਂ ਹੀ ਬੱਚਾ ਪੰਜਾਬੀ ਬੋਲਣਾ ਸਿੱਖਦਾ ਹੈ ਮਾਂ ਵੀ ਉਹ ਪੰਜਾਬੀ ਵਿੱਚ ਬੋਲਣਾ ਸਿੱਖਦਾ ਸਾਡੀ ਮਾਂ ਬੋਲੀ ਪੰਜਾਬੀ ਹੈ ਸਾਨੂੰ ਮਾਂ ਬੋਲੀ ਨਾਲ ਬਹੁਤ ਪਿਆਰ ਹੁੰਦਾ ਹੈ ਪਰ ਅੱਜ ਕੱਲ੍ਹ ਦੀ ਸਥਿਤੀ ਇਹ ਹੈ ਕਿ ਜ਼ਿਆਦਾਤਰ ਜਿਹੜੇ ਮਾਂ ਬਾਪ ਹੈ ਉਹ ਹਿੰਦੀ ਅਤੇ ਅੰਗਰੇਜ਼ੀ ਚਾਹੁੰਦੇ ਆ ਕਿ ਉਹਨਾਂ ਉਹਨਾਂ ਬੱਚਾ ਬੋਲੇ ਅਤੇ ਸਕੂਲਾਂ ਅਤੇ ਬਾਕੀ ਵਿੱਦਿਅਕ ਅਦਾਰਿਆਂ ਵਿੱਚ ਵੀ ਪੰਜਾਬੀ ਅਤੇ ਹਿੰਦੀ ਅਤੇ ਅੰਗਰੇਜ਼ੀ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਅਤੇ ਪੰਜਾਬੀ ਬਹੁਤ ਹੀ ਪਿੱਛੇ ਸਥਾਨ 'ਤੇ ਚਲੀ ਗਈ ਹੈ ਪੰਜਾਬੀ ਪਿੱਛੇ ਸਥਾਨ 'ਤੇ ਜਾਣ ਕਾਰਨ ਨਾ ਤਾਂ ਬੱਚੇ ਪੰਜਾਬੀ ਸਹੀ ਤਰੀਕੇ ਬੋਲ ਪਾਉਂਦੇ ਨਾ ਹਿੰਦੀ ਸਹੀ ਤਰੀਕੇ ਬੋਲ ਪਾਉਂਦੇ ਅਤੇ ਨਾ ਹੀ ਅੰਗਰੇਜ਼ੀ ਸਹੀ ਤਰੀਕੇ ਬੋਲ ਪਾਉਂਦੇ ਹੈ ਅਤੇ ਜੇ ਉਹ ਪੰਜਾਬੀ ਇੰਗ ਅੰਗਰੇਜ਼ੀ ਅਤੇ ਹਿੰਦੀ ਸਹੀ ਤਰੀਕੇ ਨਹੀਂ ਬੋਲ ਪਾਉਂਦੇ ਤਾਂ ਉਹਨਾਂ ਦੀ ਭਾਸ਼ਾ ਕੋਈ ਵੀ ਸਹੀ ਤਰੀਕੇ ਦੀ ਨੌਲੇਜ ਨਹੀਂ ਹੁੰਦੀ ਉਹਨਾਂ ਨੂੰ ਅਤੇ ਪੰਜਾਬ ਵਿੱਚ ਰਹਿ ਕੇ ਪੰਜਾਬੀ ਜੇ ਬੱਚੇ ਨੂੰ ਨਹੀਂ ਆਏਗੀ ਤਾਂ ਫਿਰ ਪੰਜਾਬ ਵਿੱਚ ਰਹਿਣ ਦਾ ਫਾਇਦਾ ਹੀ ਕੀ ਹੈ ਪੰ ਹਿੰਦੀ ਵੀ ਸਿੱਖੋ ਅੰਗਰੇਜ਼ੀ ਵੀ ਸਿੱਖੋ ਪਰ ਪੰਜਾਬੀ ਨੂੰ ਨਾ ਭੁੱਲੋ ਪੰਜਾਬੀ ਨਾ ਹੁਣ ਨਾ ਮਹੱਤਵ ਦੇਣ ਕਰਕੇ ਪੰਜਾਬੀ ਨੂੰ ਅੱਜ ਕੱਲ੍ਹ ਬੱਚੇ ਜਿਹੜੇ ਹੈਗੇ ਆ ਉਹ ਆਪਦੇ ਸੱਭਿਆਚਾਰ ਸੱਭਿਆਚਾਰ ਤੋਂ ਵੀ ਬਹੁਤ ਦੂਰ ਹੁੰਦੇ ਜਾਂਦੇ ਪਏ ਆ ਨਾ ਉਹਨਾਂ ਨੂੰ ਰੀਤੀ ਰਿਵਾਜ਼ਾਂ ਬਾਰੇ ਪਤਾ ਹੈ ਅਤੇ ਨਾ ਉਹਨਾਂ ਨੂੰ ਕੁਛ ਹੋਰ ਪਤਾ ਹੈ ਪੰਜਾਬੀ ਬਹੁਤ ਹੀ ਜ਼ਿਆਦਾ ਦੂਰ ਕਰੀ ਜਾ ਰਹੇ ਹੈ ਆਪਣੇ ਪੰਜਾ ਪੰਜਾਬੀ ਆਪਦੀ ਪੰ ਪੰਜਾਬੀ ਭਾਸ਼ਾ ਨਾਲ ਜੁੜੇ ਨਹੀਂ ਅਤੇ ਆਪਦੀ ਧਰਤੀ ਤੋਂ ਵੀ ਬਹੁਤ ਦੁਖੀ ਦੁਖੀ ਮਹਿਸੂਸ ਕਰਦੇ ਹੈ ਨਾ ਹੀ ਉਹਨਾਂ ਨਾਲ ਜੁੜੇ ਹੁੰਦੇ ਹੈ ਅਤੇ ਇਸ ਕਰਕੇ ਸਾਨੂੰ ਪੰਜਾਬੀ ਨੂੰ ਵੀ ਮਹੱਤਵ ਦੇਣਾ ਚਾਹੀਦਾ ਅਤੇ ਬਾਕੀ ਭਾਸ਼ਾ ਨੂੰ ਵੀ ਮਹੱਤਵ ਦੇਣਾ ਚਾਹੀ ਪਰ ਪੰਜਾਬੀ ਨੂੰ ਵੀ ਇੱਕ ਸਿਲੇਬਸ ਦਾ ਹਿੱਸਾ ਮੰਨ ਕੇ ਨਹੀਂ ਬਲਕਿ ਉਹਨੂੰ ਆਪਣੇ ਰੀਤੀ ਰਿਵਾਜ਼ਾਂ ਨੂੰ ਉਹਨੂੰ ਜਾਣਨ ਬਾਰੇ ਇਹ ਸੋਚ ਕੇ ਆਪਾਂ ਨੂੰ ਪੰਜਾਬੀ ਪੜ੍ਹਨਾ ਚਾਹੀਦਾ ਹੈ ਧੰਨਵਾਦ